ਹਾਂ ਸਾਡੇ ਪੰਜਾਬ ਵਿੱਚ ਤਾਂ ਨਵਜੰਮੇ ਬੱਚੇ ਲਈ ਤਾਂ ਬਹੁਤ ਰਸਮਾਂ ਹੁੰਦੀਆਂ ਹਨ ਜਦੋਂ ਘਰ 'ਚ ਨਵਾਂ ਬੱਚਾ ਆ ਜਾਂਦਾ ਤਾਂ ਘਰ 'ਚ ਖੁਸ਼ੀਆਂ ਦਾ ਮਹੌਲ ਹੀ ਛਾ ਜਾਂਦਾ ਘਰ 'ਚ ਬਾਹਰੋਂ ਹੀ ਪਤਾ ਲੱਗ ਜਾਂਦਾ ਕਿਉਂਕਿ ਬਾਹਰ ਕਾਫੀ ਤਰ੍ਹਾਂ ਦੀਆਂ ਚੀਜ਼ਾਂ ਟੰਗੀਆਂ ਜਾਂਦੀਆਂ ਗੁਬਾਰੇ ਸ਼ਗਨਾਂ ਵਾਲੇ ਧਾਗੇ ਪੱਤੇ ਬ ਫੁੱਲ ਬੂਟੇ ਕਾਫੀ ਟੰਗੇ ਜਾਂਦੇ ਕਿ ਆਉਂਦੇ ਜਾਂਦੇ ਨੂੰ ਹਰ ਨੂੰ ਪਤਾ ਲੱਗ ਜਾਵੇ ਕਿ ਇਸ ਘਰ ਵਿੱਚ ਕੋਈ ਨਵਜੰਮਿਆ ਬੱਚਾ ਆਇਆ ਹੈ ਜਿਸ ਦਾ ਸਵਾਗਤ ਕੀਤਾ ਜਾਂਦਾ ਹੈ ਫੇਰ ਅਸੀਂ ਬੱਚੇ ਨੂੰ ਤੇਰ੍ਹਾਂ ਦਿਨਾਂ 'ਤੇ ਇੱਕ ਨਵਾਂ ਕੱਪੜਾ ਪਾ ਕੇ ਨਲਾਈਦਾ ਹੈ ਫਿਰ ਉਸ ਤੋਂ ਬਾਅਦ ਸਵਾ ਮਹੀਨੇ ਬਾਅਦ ਉਹਨੂੰ ਨਾਮਕਰਨ ਕਰੀਦਾ ਉਹਨੂੰ ਨਵਾਈ ਧਵਾਈ ਦਾ ਨਵੇਂ ਕੱਪੜੇ ਪਾਈ ਦੇ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਈਦਾ ਉਹਨਾਂ ਦਾ ਰੋਟੀ ਪਾਣੀ ਕਰੀਦਾ ਫੇਰ ਸਾਰੇ ਬੱਚੇ ਨੂੰ ਦੇਖਦੇ ਆ ਤਾਂ ਕਾਫੀ ਸ਼ਗਨ ਸ਼ੁਗਨ ਦਿੰਦੇ ਉਹਨੂੰ ਬੱਚੇ ਨੂੰ ਬੱਚੇ ਦੇ ਕਈ ਸ਼ਗਨ ਕਰਦੇ ਹੈ ਜਿਹਦੇ ਨਾਲ ਘਰ 'ਚ ਬਹੁਤ ਖੁਸ਼ੀਆਂ ਦਾ ਮਾਹੌਲ ਫੈਲਦਾ ਆ ਸਾਰਿਆਂ ਨੂੰ ਬਹੁਤ ਚੰਗਾ ਜਿਹਾ ਲੱਗਦਾ ਆ ਇਸ ਬਹਾਨੇ ਨਵਜੰਮੇ ਬੱਚੇ ਦੀ ਮਤਲਬ ਸਵਾਗਤ ਹੋ ਜਾਂਦਾ ਕਿ ਬੱਚਾ ਘਰ 'ਚ ਆਇਆ ਆ ਫਿਰ ਬੱਚੇ ਦੇ ਮੁੰਨਣ ਹੁੰਦੇ ਵਾਲਕਰਨ ਉਹਨਾਂ ਦੇ ਕੱਟੇ ਜਾਂਦੇ ਨਾਮਕਰਨ ਹੁੰਦਾ ਬੱਚੇ ਦਾ ਕਈ ਕੰਮ ਹੁੰਦੇ ਇੱਦਾਂ ਦੇ ਪੰਜਾਬ 'ਚ ਤਾਂ ਬਹੁਤ ਹੀ ਇਹ ਚੀਜ਼ਾਂ ਨੂੰ ਮੰਨਿਆ ਜਾਂਦਾ ਆ ਇਹ ਚੀਜ਼ਾਂ ਨੂੰ ਬਹੁਤ ਅੱਗੇ ਰੱਖਿਆ ਜਾਂਦਾ ਆ ਤਾਂ ਬੱਚੇ ਇਸ ਇਸ ਬੱਚੇ ਦਾ ਸਵਾਗਤ ਹੁੰਦਾ ਬੱਚੇ ਦੇ ਯਾਦਗਾਰ ਚੀਜ਼ਾਂ ਬਣਦੀਆਂ ਜਦੋਂ ਕੱਲ੍ਹ ਨੂੰ ਬੱਚਾ ਵੱਡਾ ਹੁੰਦਾ ਤਾਂ ਅਸੀਂ ਉਹਨੂੰ ਫੋਟੋਆਂ ਦਿਖਾਉਂਦੇ ਹਾਂ ਮੂਵੀਆਂ ਦਿਖਾਉਂਦੇ ਹਾਂ ਕਿ ਅਸੀਂ ਤੇਰਾ ਦੇਖ ਆਹ ਕੀਤਾ ਸੀਗਾ ਤੇਰੇ ਮਤਲਬ ਨਾਮਕਰਨ ਕੀਤਾ ਤੈਨੂੰ ਚੋਲਾ ਪਾਇਆ ਪਹਿਲੀ ਵਾਰੀ ਗੁਰਦੁਆਰੇ ਲੈ ਗਏ ਮੰਦਰ ਲੈ ਗਏ ਤਾਂ ਤੈਨੂੰ ਦਰਸ਼ਨ ਕਰਵਾਏ ਬਾਬੇ ਦੇ ਉੱਥੇ ਤੇਰਾ ਨਾਮ ਨੁਮ ਕਢਵਾਇਆ ਅਕਸ਼ਰ ਉੱਥੋਂ ਨਾਮ ਤੇਰਾ ਰੱਖਿਆ ਇੱਦਾਂ ਅਸੀਂ ਘਰ 'ਚ ਫੰਕਸ਼ਨ ਕੀਤਾ ਸਾਰੇ ਰਿਸ਼ਤੇਦਾਰ ਬੁਲਾਏ ਰੋਟੀ ਪਾਣੀ ਕੀਤਾ ਉਹਨਾਂ ਦਾ ਤਾਂ ਮਤਲਬ ਸ ਸਾਰੇ ਆਏ ਗਏ ਤਾਂ ਫਿਰ ਭੰਡ ਆਉਂਦੇ ਨੱਚਣ ਘਰ 'ਚ ਤਾਂ ਇੱਦਾਂ ਕਈ ਲੋਕ ਆਉਂਦੇ ਜਾਂਦੇ ਲੈਣ ਦੇਣ ਵਾਲੇ ਵੀ ਜਿਹੜੇ ਖੁਸ਼ੀਆਂ ਨਾਲ ਸ਼ਗਨ ਮੰਗਦੇ ਫੇਰ ਉਹਨਾਂ ਨੂੰ ਸ਼ਗਨ ਦਈਦਾ ਆ ਇੱਦਾਂ ਕਰਕੇ ਅਸੀਂ ਆਪਣੇ ਬੱਚੇ ਦਾ ਸਵਾਗਤ ਕਰਦੇ ਪਏ ਫਿਰ ਉਸ ਤੋਂ ਬਾਅਦ ਇੱਕ ਜਦੋਂ ਬੱਚਾ ਇੱਕ ਸਾਲ ਦਾ ਹੋ ਜਾਂਦਾ ਉਹਦਾ ਜਨਮਦਿਨ ਆਉਂਦਾ ਤਾਂ ਪਹਿਲਾ ਜਨਮਦਿਨ ਵੀ ਅਸੀਂ ਲੋਕ ਬੜੀ ਧੂਮਧਾਮ ਨਾਲ ਮਨਾਉਂਦੇ ਹਾਂ ਬੱਚਿਆਂ ਦਾ ਤਾਂ ਕਿ ਚਲੋ ਇਹ ਯਾਦਗਾਰ ਹੁੰਦੀ ਆ ਨਾਲੇ ਬੱਚੇ ਰੱਬ ਦਾ ਰੂਪ ਹੁੰਦੇ ਆ ਤੋਹਫੇ ਹੁੰਦੇ ਮਾਂ ਬਾਪ ਲਈ ਤਾਂ ਇਹ ਚੀਜ਼ਾਂ ਦੁਬਾਰਾ ਨਹੀਂ ਮਿਲਦੀਆਂ ਤਾਂ ਇਸ ਕਰਕੇ ਪੰ ਅਸੀਂ ਲੋਕ ਤਾਂ ਬਹੁਤ ਹੀ ਮਨਾਉਂਦੇ ਹਾਂ ਜੀ ਬੱਚਿਆਂ ਦਾ